ਕੀ ਤੁਸੀਂ ਆਪਣੀਆਂ ਫੋਟੋਆਂ ਨੂੰ ਕਿਵੇਂ ਸੰਪਾਦਿਤ ਕਰਦੇ ਹੋ ਕਿ ਤੁਹਾਡੇ ਕੋਲ ਕੋਈ ਮਨ ਪਸੰਦ ਸੰਪਾਦਨ ਸੋਫਟਵੇਅਰ ਜਾਂ ਤਕਨੀਕ ਹੈ ਜੋ ਤੁਸੀਂ ਆਪਣੀਆਂ ਤਸਵੀਰਾਂ ਨੂੰ ਵਧਾਉਣ ਲਈ ਵਰਤਦੇ ਹੋ ਜੀ ਨਹੀਂ ਮੇਰੇ ਕੋਲ ਅਜਿਹਾ ਕੋਈ ਸੰਪਾਦਿਤ ਫੋਟੋ ਨਹੀਂ ਹੈ ਮੈਂ ਆਪਣੀਆਂ ਤਸਵੀਰਾਂ ਨੂੰ ਪੈਨ ਡਰਾਈਵ ਦੇ ਵਿੱਚ ਸਟੋਰ ਕਰਨਾ ਪਸੰਦ ਕਰਦੀ ਹਾਂ ਅਤੇ ਅੱਜ ਦੇ ਟਾਈਮ ਵਿੱਚ ਮੇਰੇ ਕੋਲ ਬਹੁਤ ਸਾਰੇ ਪੈਨ ਡਰਾਈਵ ਉਪਲਬਧ ਹਨ ਜਿਸ ਨੂੰ ਮੈਂ ਆਪਣੀਆਂ ਤਸਵੀਰਾਂ ਸੰਭਾਲ ਸਕਦੀ ਹਾਂ ਇਸ ਤਰ੍ਹਾਂ ਮੇਕੋ ਤਸਵੀਰਾਂ ਦਾ ਬਹੁਤ ਵਾਧਾ ਹੈ ਮੇਰੇ ਕੋਲ ਬੱਚਿਆਂ ਦੀਆਂ ਛੋਟੇ ਹੁੰਦੇ ਦੀਆਂ ਬਹੁਤ ਸਾਰੀਆਂ ਤਸਵੀਰਾਂ ਹਨ ਅਤੇ ਆਪਣੇ ਪੁਰਾਣੇ ਸਮੇਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਹਨ ਜਿਸ ਨੂੰ ਮੈਂ ਬਹੁਤ ਸੰਜੋਅ ਕੇ ਰੱਖਿਆ ਹੋਇਆ ਹੈ ਅਤੇ ਸਮੇਂ ਸਮੇਂ 'ਤੇ ਮੈਂ ਉਹਨਾਂ ਨੂੰ ਆਪਣੇ ਮੋਬਾਇਲ ਜਾਂ ਟੀਵੀ ਦੇ ਨਾਲ ਜੋੜ ਕੇ ਇਸ ਦਾ ਆਨੰਦ ਖੁਦ ਅਤੇ ਪਰਿਵਾਰ ਨੂੰ ਭਰਪੂਰ ਦਿੰਦੇ ਹਾਂ